ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਠੀਕ ਹੋ ਹਾਂ ਵਧੀਆ ਹਾਂ ਮੰਮਾ ਠੀਕ ਆ ਰੂਮ ਵਧੀਆ ਵਾ ਮੰਮਾ ਹਾਂ ਮੰਮਾ ਇੱ ਇੱਕ ਪੱਖਾ ਅਤੇ ਇੱਕ ਬੈਡ ਵਗੈਰਾ ਦਿੱਤਾ ਹੋਇਆ ਵਧੀਆ ਰੂਮ ਆ ਹਾਂ ਮੈਂ ਮੰਮਾ ਵਧੀਆ ਚਲਣ ਡਿਆ ਟੀਚਰਸ ਵੀ ਵਧੀਆ ਵਧੀਆ ਵਾ ਨੇਚਰ ਉਹਨਾਂ ਦਾ ਹਾਂ ਮੰਮਾ ਇੱਕ ਇੱਕ ਰੂਮਮੇਟ ਹੈ ਨਾਲ ਠੀਕ ਹੈ ਮੰਮਾ ਪੱਖਾ ਅਤੇ ਫੈਨ ਵੀ ਦਿੱਤਾ ਹੋਇਆ ਵਾ

ਹਾਂ ਤਿੰਨ ਟਾਈਮ ਖਾਣਾ ਦਿੰਦੇ ਪਏ ਮੰਮਾ ਅਤੇ ਇੱਕ ਵਿੱਚ ਫਰੂਟ ਦੇ ਰਹੇ ਹੈ ਵਿੱਚ ਕੋਈ ਵੀ ਮਤਲਬ ਕਿ ਐਡੀਸ਼ਨਲ ਫਰੂਟ ਹਾਂ ਨਹੀਂ ਨਹੀਂ ਸਭ ਵਧੀਆ ਮੰਮਾ ਵਧੀਆ ਸਾਰਾ ਕੁਛ